ਸਾਡੇ ਪੰਜਾਬ ਵਿੱਚ ਪ੍ਰਮੁੱਖ ਖੇਡ ਟੀਮਾਂ ਬਹੁਤ ਹਨ ਜਿਵੇਂ ਕਿ ਪੰਜਾਬ ਕ੍ਰਿਕਟ ਟੀਮ ਪੰਜਾਬ ਹੋਕੀ ਟੀਮ ਪੰਜਾਬ ਕਬੱਡੀ ਟੀਮ ਇਹ ਸਾਰੀਆਂ ਹੀ ਖੇਡਾਂ ਇਹ ਸਾਰੀਆਂ ਹੀ ਜਿੰਨੇ ਵੀ ਪੰਜਾਬ ਦੀਆਂ ਟੀਮਾਂ ਹਨ ਇਹਨਾਂ ਨੂੰ ਲੋਕੀ ਦੇਖਣਾ ਬਹੁਤ ਹੀ ਜ਼ਿਆਦਾ ਵਧੀਆ ਮ ਮਤਲਬ ਲੋਕਾਂ ਨੇ ਇਹਨਾਂ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤਾਂ ਜਿੱਦਾਂ ਕਿ ਕ੍ਰਿਕਟ ਟੀਮ ਹੋਈ ਅੱਜ ਕੱਲ੍ਹ ਆਈ ਪੀ ਐਲ ਬਹੁਤ ਹੀ ਜ਼ਿਆਦਾ ਚੱਲਦਾ ਪਿਆ ਹੈ ਲੋਕਾਂ ਨੂੰ ਇੰਨਾਂ ਨੂੰ ਵੇਖ ਕੇ ਇੰਨਾਂ ਹੀ ਵਧੀਆ ਲੱਗਦਾ ਹੈ ਲੋਕਾਂ ਦਾ ਮੰਨੋਰੰਜਨ ਹੁੰਦਾ ਹੈ ਲੋਕ ਇਹਨਾਂ 'ਤੇ ਇੰਨਾਂ ਵਿਸ਼ਵਾਸ ਰੱਖਦੇ ਹਨ ਕਿ ਸੱਟੇ ਵਗੈਰਾ ਲਾਉਣ ਲੱਗ ਪੈਂਦੇ ਹਨ ਔਰ ਆਪਣਾ ਮਤਲਬ ਟਾਈਮ ਬਚਾ ਕੇ ਆਈ ਪੀ ਐਲ ਵੇਖਣ ਲਈ ਲੋਕ ਕਿੰਨੀ ਦੂਰ ਤੱਕ ਪੁੱਜੇ ਹੁੰਦੇ ਆ ਜਿਵੇਂ ਕਿ ਆਪਣੇ ਘਰ ਦੇ ਕੰਮ ਕਾਰ ਛੇਤੀ ਕਰਕੇ ਜਾਂ ਕੋਈ ਬਾਹਰ ਦੇ ਕੰਮ ਕਰਕੇ ਆਈ ਪੀ ਐਲ ਮੈਚ ਦੇਖਦੇ ਹਨ ਮਤਲਬ ਇਹਨਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ